ਮੇਰੇ ਮਨਪਸੰਦ ਸ਼ਬਦ ਪੰਜਾਬੀ ਸ਼ਬਦ ਹਨ ਸੱਜਣਾ ਅਤੇ ਰਾਹੀ ਇਹ ਦੋਵੇਂ ਸ਼ਬਦ ਪੰਜਾਬੀ ਭਾਸ਼ਾ ਦੀ ਮਿਠਾਸ ਨੂੰ ਅਤੇ ਮੁਹੱਬਤ ਦਾ ਪ੍ਰਤੀਕ ਹਨ ਸੱਜਣਾ ਸ਼ਬਦ ਪਿਆਰ ਅਤੇ ਨੇੜਤਾ ਨੂੰ ਦਰਸਾਉਂਦਾ ਹੈ ਇਸ ਲਈ ਮੈਂ ਕਹਿ ਸਕਦੀ ਹਾਂ ਕਿ ਇਹ ਸ਼ਬਦ ਮੇਰਾ ਮਨਪਸੰਦ ਹੈ ਅਤੇ ਜਿਹੜਾ ਕਿ ਯਾਤ ਰਾਹੀ ਸ਼ਬਦ ਹੈ ਇਹ ਯਾਤਰੀ ਲਈ ਵਰਤਿਆ ਜਾਂਦਾ ਜੋ ਕਿ ਮਾਨਤਾ ਹੈ ਕਿ ਹਰ ਕੋਈ ਇਸ ਜ਼ਿੰਦਗੀ ਦੇ ਸਫਰ 'ਤੇ ਹੈ ਇਸ ਲਈ ਮੈਂ ਦੋਨੋਂ ਸ਼ਬਦ ਕਹਿ ਸਕਦੀ ਹਾਂ ਕਿ ਮੇਰੇ ਮਨਪਸੰਦ ਹਨ ਕਿਉਂਕਿ ਇਹ ਦੋਨੋਂ ਨੇੜਤਾ ਦਿਖਾਉਂਦੇ ਹੈ ਤਾਂ ਕਿ ਦੋ ਪਰਸਨਸ ਦੇ ਵਿੱਚ ਨੇੜਤਾ ਦਿਖਾਉਂਦੇ ਹੈ ਪੰਜਾਬੀ ਭਾਸ਼ਾ ਦੇ ਮੂਲ ਬੁਲਾਰੇ ਹੋਣ 'ਤੇ ਮਾਣ ਮਹਿਸੂਸ ਕਰਦਾ ਅਤੇ ਕਿਉਂਕਿ ਪੰਜਾਬੀ ਸੱਭਿਆਚਾਰ ਬਹੁਤ ਹੀ ਸਮਰਥਿਤ ਅਤੇ ਰੰਗੀਨ ਹੈ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਆ ਜਾਂਦਾ ਜਿਵੇਂ ਕਿ ਪੰਜਾਬ ਵਿੱਚ ਭੰਗੜਾ ਕਰਦੇ ਆ ਲੋਕ ਗਿੱਧਾ ਪਾਉਂਦੀਆਂ ਕੁੜੀਆਂ ਇਹ ਸਾਰਾ ਕੁਝ ਪੰਜਾਬੀ ਸੱਭਿਆਚਾਰ ਹੈ ਅਤੇ ਪੰਜਾਬੀ ਸੱਭਿਆਚਾਰ ਸਾਰੇ ਹੀ ਸਾਰੇ ਹੀ ਦੇਸ਼ ਵਿੱਚ ਬਹੁਤ ਪ੍ਰਚੱਲਿਤ ਹੈ ਅਤੇ ਇਹ ਭਾਸ਼ਾ ਨਾ ਸਿਰਫ ਮੇਰੀ ਪਛਾਣ ਹੈ ਸਗੋਂ ਮੇਰੀ ਵਰਸ ਮੇਰੇ ਵਿਰਸੇ ਸੱਭਿਆਚਾਰ ਦੀ ਵੀ ਦਾਤ ਹੈ ਪੰਜਾਬੀ ਭਾਸ਼ਾ ਦੀ ਮਿਠਾਸ ਇਹਦੇ ਗੀਤ ਕਵਿਤਾ ਜਿਹੜੇ ਕਿ ਸਾਰੇ ਦੇਸ਼ ਵਿੱਚ ਇਹਨਾਂ ਦੀ ਗੂੰਜਦੀ ਹੈ ਅਵਾਜ਼ ਗੂੰਜਦੀ ਹੈ ਅਤੇ ਲੋਕ ਇਸਨੂੰ ਬਹੁਤ ਪਸੰਦ ਕਰਦੇ ਹੈ ਇਸ ਲਈ ਮੈਂ ਇਹ ਕਹੂੰਗੀ ਕਿ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਅਤੇ ਇਹਦੇ ਵਿੱਚ ਸਭ ਤੋਂ ਵਧੀਆ ਸ਼ਬਦ ਹਨ ਸੱਜਣਾ ਅਤੇ ਰਾਹੀ